ਮੈਨੂੰ ਨਾਰੀਅਲ ਦਾ ਲੱਡੂ ਬਹੁਤ ਪਸੰਦ ਹੈ ਇਸ ਨੂੰ ਬਣਾਉਣ ਲਈ ਅਸੀਂ ਇਸ ਵਿੱਚ ਖੰਡ ਨਾਰੀਅਲ ਦਾ ਬੁਰਾਦਾ ਨਾਰੀਅਲ ਨੂੰ ਅਸੀਂ ਜੇ ਸਾਡੇ ਘਰ ਵਿੱਚ ਨਾਰੀਅਲ ਹੈ ਤਾਂ ਅਸੀਂ ਉਸਨੂੰ ਹੀ ਗ੍ਰੈਂਡ ਕਰਕੇ ਉਹਦੇ ਵਿੱਚ ਮਸਾਲੇ ਦੇ ਤੌਰ 'ਤੇ ਜਿਵੇਂ ਕਿ ਇਲਾਇਚੀ ਹੋ ਗਿਆ ਇਲਾਇਚੀ ਪਾਊਡਰ ਹੋ ਗਿਆ ਲੋਂਗ ਹੋ ਗਿਆ ਅਤੇ ਖੰਡ ਨੂੰ ਪੀਸ ਕੇ ਇਸਨੂੰ ਸਾਰਿਆਂ ਦਾ ਪੇਸਟ ਬਣਾ ਕੇ ਖੰਡ ਦੀ ਥੋੜ੍ਹੀ ਜਿਹੀ ਚਾਸ਼ਣੀ ਬਣਾ ਕੇ ਇਹਨਾਂ ਨੂੰ ਮਿਕਸ ਕਰਕੇ ਅਸੀਂ ਇਸਦਾ ਇਸਦਾ ਛੋਟੇ ਛੋਟੇ ਗੋਲ ਗੋਲ ਲੱਡੂ ਬਣਾ ਸਕਦੇ ਹਾਂ ਇਹ ਕਈ ਤਰ੍ਹਾਂ ਦਾ ਬਣਦਾ ਹੈਗਾ ਹੈ ਇਸ ਵਿੱਚ ਅਸੀਂ ਕਈ ਰੰਗਾਂ ਦਾ ਬਣਾ ਸਕਦੇ ਹਾਂ ਜਿਵੇਂ ਕਿ ਹਰਾ ਵਾਈਟ ਲਾਲ ਸਾਨੂੰ ਜਿਸ ਵੀ ਰੰਗ ਦਾ ਖਾਣਾ ਹੈ ਅਸੀਂ ਉਹ ਕਲਰ ਮਿਲਾ ਸਕਦੇ ਹਾਂ ਇਸ ਵਿੱਚ ਅਤੇ ਇਹ ਕਾਫੀ ਟੇਸਟੀ ਹੁੰਦਾ ਹੈ ਖਾਣ ਨਾਲ ਮੈਂ ਇਸ ਇਹ ਸਾਡੀ ਫੈਮਿਲੀ ਵਿੱਚ ਸਾਰੇ ਹੀ ਖਾਂਦੇ ਹਾਂ ਅਤੇ ਇਹ ਹਰ ਸਾਲ ਸਾਡੇ ਘਰ ਵਿੱਚ ਆਉਂਦਾ ਹੈ ਅਸੀਂ ਇਹ ਘਰ ਵਿੱਚ ਵੀ ਬਣਾ ਸਕਦੇ ਹਾਂ ਜਦ ਵੀ ਦਿਲ ਕੀਤਾ ਖਾਣ ਨੂੰ ਅਸੀਂ ਇਹ ਘਰ ਵਿੱਚ ਬਣਾ ਕੇ ਆਪਣੇ ਹੱਥਾਂ ਨਾਲ ਬਣਾ ਸਕਦੇ ਹਾਂ ਇਸ ਨੂੰ ਜ਼ਿਆਦਾ ਮਿਹਨਤ ਨਹੀਂ ਕ ਲੱਗਦੀ ਹੈ ਅਤੇ ਇਸ ਵਿੱਚ ਜ਼ਿਆਦਾ ਕੋਈ ਸਮੱਗਰੀ ਨਹੀਂ ਲੱਗਦੀ ਹੈ ਬਣਾਉਣ ਵਿੱਚ ਇਹ ਕਾਫੀ ਸੌਖਾ ਤਰੀਕਾ ਹੈ ਬਣਾਉਣ ਦਾ ਅਸੀਂ ਇਸ ਨੂੰ ਬਣਾ ਸਕਦੇ ਹਾਂ